ਹਾਂ ਥੋੜ੍ਹਾ ਬਹੁਤਾ ਤਾਂ ਪਿੰਡ 'ਚ ਹੁੰਦਾ ਹੈ ਕਿ ਪੇਂਡੂ ਖੇਤਰ ਦੇ ਵਿੱਚ ਜੇ ਅਸੀਂ ਵਿਆਹ ਕਰਨਾ ਹੈ ਤਾਂ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਅੱਜ ਕੱਲ੍ਹ ਹਰ ਕੋਈ ਇਹੀ ਚਾਹੁੰਦਾ ਹੈ ਕਿ ਅਸੀਂ ਸ਼ਹਿਰਾਂ ਦੇ ਨੇੜੇ ਵਸੇ ਉੱਥੇ ਰਹੀਏ ਕਿ ਤਾਂ ਕਿ ਸਾਨੂੰ ਸਹੂਲਤਾਂ ਬਜ਼ਾਰ ਆਉਣਾ ਜਾਣਾ ਈਜ਼ੀ ਰਹੇ